ਹਾਂ ਅਸੀਂ ਮਹਿਸੂਸ ਕ ਅਸੀਂ ਮਹਿਸੂਸ ਕਰਦੇ ਹਾਂ ਕਿ ਗਰੀਬੀ ਚੰਗੀ ਡਾਕਟਰੀ ਦੇਖਭਾਲ ਤੱਕ ਪਹੁੰਚਣ ਵਿੱਚ ਇੱਕ ਰੁਕਾਵਟ ਹੈ ਕਿਉਂਕਿ ਇੱਥੇ ਪ੍ਰਾਈਵੇਟ ਹੋਸਪਿਟਲਾਂ ਵਿੱਚ ਜ਼ਿਆਦਾ ਖਰਚਾ ਹੋਣ ਦੇ ਬਾਵਜੂਦ ਗਰੀਬ ਲੋਕਾਂ ਲੋਕ ਪੈਸੇ ਨਹੀਂ ਦੇ ਸਕਦੇ ਉਪਰੇਸ਼ਨ ਵਗੈਰਾ ਨਹੀਂ ਕਰਾ ਸਕਦੇ ਅਤੇ ਆਪਣੀ ਬਿਮਾਰੀਆਂ ਦਾ ਇਲਾਜ ਵੀ ਨਹੀਂ ਕਰਾ ਸਕਦੇ ਕਿਉਂਕਿ ਇਥੇ ਮਹਿੰਗਾਈ ਦੇ ਤੌਰ 'ਤੇ ਖਰਚਾ ਬਹੁਤ ਹੁੰਦਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਪੇਂਡੂ ਖੇਤਰਾਂ ਵਿੱਚ ਇੱਕ ਕੋਈ ਡਿਸਪੈਂਸਰੀ ਇੱਕ ਡਿਸਪੈਂਸਰੀ ਬਣਾਵੇ ਅਤੇ ਗਰੀਬ ਲੋਕਾਂ ਨੂੰ ਫ੍ਰੀ ਇਲਾਜ ਦਾ ਕਰਾਵੇ ਅਤੇ ਉਹਨਾਂ ਦੇ ਕਾਰਡ ਵਗੈਰਾ ਵੀ ਬਣਾ ਬਣਾਉਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ